ਪਟਿਆਲਾ ਸ਼ਹਿਰ ਇੱਕ ਪੁਰਾਣਾ ਇਤਿਹਾਸਿਕ ਅਤੇ ਸ਼ਾਹੀ ਸ਼ਹਿਰ ਹੈ ਬਹੁਤਾਤ ਦੇ ਵਿੱਚ ਇੱਥੇ ਨੌਕਰੀ ਪੇਸ਼ਾ ਲੋਕਾਂ ਦੀ ਵਸੋਂ ਜ਼ਿਆਦਾ ਹੈ ਅਤੇ ਸ਼ਾਇਦ ਇਹ ਇਕਲੌਤਾ ਸ਼ਹਿਰ ਹੋਵੇਗਾ ਦੇਸ਼ ਦਾ ਜਿੱਥੇ ਕਿ ਹਰ ਤਰ੍ਹਾਂ ਦੇ ਵਿੱਦਿਅਕ ਅਦਾਰੇ ਮੌਜੂਦ ਹਨ ਜਿੱਦਾਂ ਕਿ ਮੈਡੀਕਲ ਕੋਲੇਜ ਆਯੁਰਵੈਦਿਕ ਕੋਲੇਜ ਇੰਜੀਨੀਅਰਿੰਗ ਕੋਲੇਜ ਲਾਅ ਯੂਨੀਵਰਸਿਟੀ ਖੇਡ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਅ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਅਤੇ ਬਹੁਤ ਸਾਰੇ ਅ ਸਰਕਾਰੀ ਸੰਸਥਾਨਾਂ ਦੇ ਹੈਡ ਔਫਿਸ ਇੱਥੇ ਹੋਣ ਕਾਰਨ ਜ਼ਿਆਦਾਤਰ ਇੱਥੇ ਦੇ ਲੋਕ ਜੋ ਹਨ ਉਹ ਸਰਕਾਰੀ ਨੌਕਰੀ ਪੇਸ਼ਾ ਹਨ ਅਤੇ ਪਿਛਲੇ ਕੁਛ ਸਾਲਾਂ ਦੇ ਵਿੱਚ ਸਰਕਾਰੀ ਅ ਨੌਕਰੀਆਂ ਦੇ ਵਿੱਚ ਘਾਟ ਦੇ ਕਾਰਨ ਨੌਜਵਾਨਾਂ ਦਾ ਜੋ ਰੁਝਾਨ ਹੈ ਉਹ ਨਿੱਜੀ ਅ ਸੈਕਟਰ ਦੇ ਵਿੱਚ ਅਤੇ ਉਸ ਤੋਂ ਇਲਾਵਾ ਸਵੈ ਰੁਜ਼ਗਾਰ ਦੇ ਵਿੱਚ ਵਧਿਆ ਹੈ ਉਸ ਤੋਂ ਇਲਾਵਾ ਨੌਜਵਾਨ ਬਹੁਤ ਗਿਣਤੀ ਦੇ ਵਿੱਚ ਹੁਣ ਬਾਹਰ ਜਾਣ ਨੂੰ ਤਰਜੀਹ ਦੇ ਰਹੇ ਹਨ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ ਕਨੇਡਾ ਅਸਟਰੇਲੀਆ ਅਮਰੀਕਾ ਆਦਿ ਜਾਣ ਦੇ ਵਿੱਚ ਉਹ ਤਰਜੀਹ ਦੇ ਰਹੇ ਹਨ